ਮੈਨੂੰ ਚਿੱਤਰਕਾਰੀ ਦਾ ਬਹੁਤ ਸ਼ੌਂਕ ਹੈ ਮੈਂ ਬਚਪਨ ਤੋਂ ਹੀ ਚਿੱਤਰਕਾਰੀ ਕਰਦੀ ਹਾਂ ਅਤੇ ਜਦੋਂ ਵੀ ਮੈਂ ਫਰੀ ਹੁੰਦੀ ਹਾਂ ਮੈਂ ਚਿੱਤਰਕਾਰੀ ਕਰਨਾ ਸਟਾਰਟ ਕਰ ਦਿੰਦੀ ਕਿਉਂਕਿ ਮੈਂ ਜਦੋਂ ਚਿੱਤਰਕਾਰੀ ਕਰਦੀ ਮੈਨੂੰ ਬਹੁਤ ਜ਼ਿਆਦਾ ਅੰਦਰੋਂ ਸਕੂਨ ਮਿਲਦਾ ਅੰਦਰੋਂ ਆਨੰਦ ਆਉਂਦਾ ਅਤੇ ਜਾਂ ਮਤਲਬ ਕਦੇ ਕਦੇ ਮੈਂ ਕੋਈ ਕੋਈ ਵਿਸ਼ਾ ਆ ਗਿਆ ਮੇਰੇ ਕੋਲ ਜਾਂ ਮੈਨੂੰ ਕੋਈ ਥੀਮ ਦਿੰਦਾ ਵੀ ਹਾਂ ਅਤੇ ਇਹਦੇ ਇਹਦੇ 'ਤੇ ਚਿੱਤਰਕਾਰੀ ਕਰਨੀ ਆ ਮੈਂ ਉਦੋਂ ਹੀ ਕਿਸੇ ਕਿ ਖਾਸ ਵਿਸ਼ੇ ਜਾਂ ਥੀਮ 'ਤੇ ਚਿੱਤਰਕਾਰੀ ਕਰਨਾ ਪਸੰਦ ਕਰਦੀ ਹਾਂ ਪਰ ਜ਼ਿਆਦਾਤਰ ਮੈਂ ਮੈਜੀਨੇਸ਼ਨ ਨਾਲ ਚਿੱਤਰਕਾਰੀ ਕਰਦੀ ਹਾਂ ਕਿਉਂਕਿ ਹੁਣ ਮੈਂ ਕੋਈ ਆਸਮਾਨ 'ਚ ਕਦੇ ਕਿਤੇ ਉਡਦੇ ਪੰਛੀ ਦੇਖ ਲਏ ਮੈਂ ਉਹਨਾਂ ਨੂੰ ਦੇਖ ਕੇ ਚਿੱਤਰਕਾਰੀ ਕਰ ਦੇਣੀ ਜਾਂ ਕੋਈ ਸੂਰਜ ਕਿਤੇ ਢੱਲ ਰਿਹਾ ਏ ਚੜ੍ਹਦਾ ਸੂਰਜ ਨੂੰ ਦੇਖਣਾ ਦੇਖ ਕੇ ਉਹਦੀ ਚਿੱਤਰਕਾਰੀ ਕਰ ਕੇ ਉਹਨੂੰ ਐਕਸਪਲੇਨ ਕਰਨਾ ਮੈਨੂੰ ਬਹੁਤ ਵਧੀਆ ਲੱਗਦਾ ਏ ਕਿਤੇ ਪਾਰਕ 'ਚ ਜਾਣਾ ਉੱਥੇ ਬੱਚੇ ਖੇਡ ਰਹੇ ਹੈ ਝੂਲਿਆਂ ਨੂੰ ਹੋਰ ਮਤਲਬ ਵਧੀਆ ਢੰਗ ਨਾਲ ਕਿ ਕਿਵੇਂ ਪਾਰਕ ਦਾ ਇੱਕ ਪਾਰਕ ਦਾ ਇਕ ਦ੍ਰਿਸ਼ ਬਣਾ ਦੇਣਾ ਅਤੇ ਕੋਈ ਸੀਨਰੀ ਹੋ ਗਈ ਕੋਈ ਮੌਸਮ ਦਾ ਦ੍ਰਿਸ਼ ਇਮੈਜਿਨ ਦੇ ਥਰੂ ਕੋਈ ਮੀਂਹ ਵਾਲਾ ਜਾਂ ਸੁਹਾਵਣਾ ਮੌਸਮ ਕਿਸੇ ਵੀ ਤਰ੍ਹਾਂ ਦਾ ਮੀਂਹ ਤੋਂ ਬਾਅਦ ਵਾਲਾ ਬਾਅਦ ਸਤਰੰਗੀ ਪੀਂਘ ਆਸਮਾਨ 'ਚ ਐਵੇਂ ਦੀ ਮੈਜੀਨੇਸ਼ਨਸ ਨਾਲ ਬਣਾ ਦੇਣੀ ਮੈਂ ਕਿਤ ਜਾਂ ਕਿਤੇ ਘੁੰਮਣ ਗਏ ਕੋਈ ਵਿਆਹਿਆ ਜੋੜਾ ਬੈਠਾ ਦਰਿਆ 'ਤੇ ਉਸ 'ਤੇ ਉੱਥੇ ਬਣਾ ਦੇ ਉਹਨਾਂ ਨੂੰ ਇਮੈਜਿਨ ਕਰ ਕੇ ਘਰ ਆ ਕੇ ਉਹਨਾਂ ਨੂੰ ਬਣਾਉਣਾ ਜਾਂ ਕਿਤੇ ਮੈਂ ਪਹਾੜਾਂ 'ਤੇ ਘੁੰਮਣ ਗਈ ਉਹਨਾਂ ਨੂੰ ਇਮੈਜਿਨ ਕਰਕੇ ਬਣਾਉਣਾ ਕੁਛ ਵੀ ਮਤਲਬ ਮੈਨੂੰ ਅੰਦਰੋਂ ਸਕੂਨ ਮਿਲਦਾ ਏ ਜਦੋਂ ਮੈਂ ਆਪਣੀ ਜਿਹੜੀ ਮੇਰੇ ਅੰਦਰ ਦੇ ਜਜ਼ਬਾਤ ਹੁੰਦੇ ਆ ਚਾਹੇ ਇਮੈਜੀਨੇਸ਼ਨ ਹੁੰਦੀ ਹੈ ਅੰਦਰ ਦੀ ਜਦੋਂ ਮੈਂ ਉਹਨਾਂ ਨੂੰ ਜਦੋਂ ਮੈਂ ਉਹਨਾਂ ਨੂੰ ਆਪਣੀ ਚਿੱਤਰਕਾਰੀ ਦੇ ਥਰੂ ਆਪਣੇ ਘਰਦਿਆਂ ਨੂੰ ਬਿਆਨ ਕਰਦੀ ਹਾਂ ਜਾਂ ਕੋਈ ਜੋ ਮੇਰੀ ਜੋ ਮੈਨੂੰ ਸਕੂਨ ਮਿਲ ਬਹੁਤ ਸਕੂਨ ਮਿਲਦਾ ਮੈਨੂੰ ਜਦੋਂ ਮੇਰੇ ਘਰਦੇ ਜੋ ਵੀ ਮੇਰੀ ਇੱਛਾ ਜਾਂ ਇਮੈਜੀਨੇਸ਼ਨ ਨੂੰ ਦੇਖਦੇ ਹੈ ਅਤੇ ਮੈਨੂੰ ਹਮੇਸ਼ਾਂ ਉਹ ਉਤਸ਼ਾਹਿਤ ਕਰਦੇ ਹੈ ਘਰਦੇ ਮੇਰੇ ਸ ਕੋਲਿਜ ਸਕੂਲ ਟੀਚਰ